ਮੇਰਾ ਨਾਮ ਮੋਨਿਕਾ ਹੈ ਮੈਂ ਤੁਹਾਨੂੰ ਅੱਜ ਯੋਗੇ ਬਾਰੇ ਦੱਸਣਾ ਚਾਹੁੰਦੀ ਹਨ ਸਾਨੂੰ ਉਸ ਨਾਲ ਕੀ ਕੀ ਲਾਭ ਹੋ ਸਕਦਾ ਹੈ ਯੋਗਾ ਇਕ ਅਜਿਹੀ ਕਲਾ ਹੈ ਜੋ ਸਰੀਰ ਨੂੰ ਮਨ ਨਾਲ ਜੋੜਨ ਦਾ ਕੰਮ ਵੀ ਕਰਦੀ ਹੈ ਯੋਗਾ ਕਰਨ ਨਾਲ ਅਸੀਂ ਸਾਰੇ ਤੰਦਰੁਸਤ ਵੀ ਰਹਿੰਦੇ ਹਨ ਅੱਜ ਕੱਲ੍ਹ ਜਦੋਂ ਅਸੀਂ ਆਪਣੇ ਸਕੂਲ ਜਾਂਦੇ ਹਨ ਤਾਂ ਸਾਨੂੰ ਵੀ ਸਾਰਿਆਂ ਤੋਂ ਪਹਿਲਾਂ ਸਾਡੇ ਕੋਚ ਸਰ ਅੱਧਾ ਘੰਟਾ ਸਾਨੂੰ ਯੋਗਾ ਸਿਖਾਉਂਦੇ ਹਨ ਉਹ ਕਹਿੰਦੇ ਹਨ ਯੋਗਾ ਕਰਨ ਨਾਲ ਸਾਡੇ ਸਰੀਰ ਵਿੱਚ ਗਰਮੀ ਆ ਜਾਂਦੀ ਹੈ ਅਤੇ ਇਸ ਨਾਲ ਸਾਨੂੰ ਕੋਈ ਵੀ ਸੱਟ ਵਗੈਰਾ ਨਹੀਂ ਲੱਗਦੀ ਅੱਜ ਕੱਲ੍ਹ ਸਾਰੇ ਲੋਕ ਜ਼ਿਆਦਾਤਰ ਯੋਗਾ ਹੀ ਕਰਦੇ ਹਨ ਅਤੇ ਯੋਗਾ ਕਰਨ ਨਾਲ ਸਾਡਾ ਸਰੀਰ ਚੰਦ ਤੰਦਰੁਸਤ ਚੁਸਤ ਅਤੇ ਹੋਰ ਵੀ ਕਈ ਪ੍ਰਕਾਰ ਦੇ ਨਾਲ ਠੀਕ ਰਹਿੰਦਾ ਹੈ ਯੋਗ ਕਰਨ ਦੀਆਂ ਕਿਸਮਾਂ ਵੀ ਹਨ ਕੁਝ ਕਿਸਮਾਂ ਹਨ ਜਿਵੇਂ ਕਿ ਕਰਮਯੋਗ ਭਗਤੀਯੋਗ ਗਿਆਨਯੋਗ ਰਾਜਯੋਗ ਅਤੇ ਹੱਠਯੋਗ ਯੋਗਾ ਕਰਨ ਨਾਲ ਸਾਡੇ ਸਰੀਰ ਤੋਂ ਦੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ ਯੋਗਾ ਕਰਕੇ ਸਾਡਾ ਮਨ ਸ਼ਾਂਤ ਵੀ ਰਹਿੰਦਾ ਹੈ ਅਤੇ ਸਾਨੂੰ ਜ਼ਿਆਦਾਤਰ ਗੁੱਸਾ ਵੀ ਨਹੀਂ ਆਉਂਦਾ ਅਤੇ ਹੋਰ ਵੀ ਜ਼ਿਆਦਾ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ